ਭੰਗੜਾ ਸਾਡੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਹਰ ਲੋਕ ਹਰ ਦੇਸ਼ ਦੇ ਵਿੱਚ ਹਰ ਅਲੱਗ ਅਲੱਗ ਲੋਕ ਨਾਚ ਹੁੰਦੇ ਹਨ ਪਰ ਪੰਜਾਬ ਦੇ ਵਿੱਚ ਭੰਗੜਾ ਹੀ ਇੱਕ ਲੋਕ ਨਾਚ ਹੈ ਭੰਗੜਾ ਅਤੇ ਗਿੱਧਾ ਔਰਤਾਂ ਅਤੇ ਮਰਦ ਦੋਵੇਂ ਹੀ ਪਾਉਂਦੇ ਹਨ ਮਲਵਈ ਗਿੱਧਾ ਮਰਦ ਵੀ ਪਾਉਂਦੇ ਹਨ ਅਤੇ ਔਰਤਾਂ ਗਿੱਧਾ ਅਤੇ ਭੰਗੜਾ ਦੋਵੇਂ ਹੀ ਪਾਉਂਦੇ ਹਨ ਇਸ ਦਾ ਇਤਿਹਾਸਿਕ ਇਹ ਦੱਸਦਾ ਹੈ ਕਿ ਜਦੋਂ ਮਰਦ ਨੇ ਇੱਕ ਵਧੀਆ ਇਤਿਹਾ ਭੰਗੜਾ ਪਾਉਂਦਾ ਹੈ ਉਹ ਉਸਦੇ ਮਲਵਾਈ ਪੱਗ ਮਾਵੇ ਵਾਲੀ ਪੱਗ ਅਤੇ ਧੋਤੀ ਕੁੜਤਾ ਕੈਂਠਾ ਪਾਇਆ ਹੁੰਦਾ ਹੈ ਜੋ ਕਿ ਦਰਸਾਉਂਦਾ ਹੈ ਪ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕਿਵੇਂ ਗਿ ਭੰਗੜਾ ਪਾਉਂਦੇ ਹਨ ਅਤੇ ਗੀਤ ਵੀ ਉਸ ਤਰੀਕੇ ਨਾਲ ਲਗਾਇਆ ਹੁੰਦਾ ਔਰਤਾਂ ਸਲਵਾਰ ਸੂਟ ਪਰਾਂਦਾ ਆਦਿ ਪਾਉਂਦੀਆਂ ਹਨ ਅਤੇ ਗੀਤਾਂ ਨੂੰ ਵੀ ਦਰਸਾਉਂਦੀਆਂ ਹਨ ਵੀ ਇਸ ਕਰਕੇ ਭੰਗੜਾ ਪਾਇਆ ਜਾਂਦਾ ਹੈ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਹਨ ਜੋ ਕਿ ਭੰਗੜਾ ਦੱਸਦਾ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਇਹ ਪੰਜਾਬ ਦਾ ਇਤਿਹਾਸ ਬਣ ਚੁੱਕਿਆ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਲੋਕਾਂ ਦਾ ਮਿਲਾਪੜਾ ਆਦਿ ਹੋਰ ਵੀ ਚੀਜ਼ਾਂ ਜੋ ਕਿ ਪੂਰਾ ਇਹੀ ਦਰਸਾਉਂਦਾ ਹੈ ਕਿ ਇਹ ਪੰਜਾਬੀਆਂ ਦਾ ਗਿੱਧਾ ਅਤੇ ਭੰਗੜਾ ਹੈ ਜਿਹੜੇ ਭੰਗੜੇ ਵਾਲੇ ਗਾਇਕ ਹੁੰਦੇ ਆ ਜੋ ਭੰਗੜਾ ਨੂੰ ਗਾਉਂਦੇ ਆ ਉਹ ਵੀ ਪ੍ਰਸਿੱਧ ਹੋ ਚੁੱਕੇ ਹਨ ਅੱਜ ਕੱਲ੍ਹ ਪੰਜਾਬੀ ਗਾਣੇ ਇਸ ਕਰਕੇ ਪ੍ਰਸਿੱਧ ਹੋ ਰਹੇ ਹਨ ਕਿਉਂਕਿ ਉਹ ਬਹੁਤ ਹੀ ਧਮਕ ਵਾਲੇ ਅਤੇ ਪੂਰੇ ਮਨੋਰੰਜਨ ਗਾਣੇ ਬਣਾਉਂਦੇ ਹਨ ਜੋ ਕਿ ਬਹੁਤ ਪ੍ਰਸਿੱਧ ਹੋ ਚੁੱਕੇ ਹਨ ਧੰਨਵਾਦ